ਹੈਲੋ ਮੇਰੀ ਗੱਲ ਓਲਾ ਆਟੋ ਨਾਲ ਹੋ ਰਹੀ ਹੈ ਅਸੀਂ ਨਾ ਇੱਥੇ ਇੱਕ ਔਡਰ ਬੁੱਕ ਕਰਾਉਣਾ ਆ ਇਕ ਕੈਬ ਬੁੱਕ ਕਰਾਉਣੀ ਆ ਅਸੀਂ ਚੰਡੀਗੜ੍ਹ ਜਾਣਾ ਚਾਹੁੰਦੇ ਹਾਂ ਉੱਥੇ ਅਸੀਂ ਕਈ ਜਿਹੜੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਮੋਲ ਹੈ ਉੱਥੇ ਅਸੀਂ ਘੁੰਮਣਾ ਚਾਹੁੰਦੇ ਹਾਂ ਅਤੇ ਉਹਦੇ ਲਈ ਸਾਨੂੰ ਇੱਕ ਪੂਰੇ ਦਿਨ ਦੇ ਲਈ ਆ ਅਸੀਂ ਕੈਬ ਬੁੱਕ ਕਰਾਉਣੀ ਆ ਅਤੇ ਅਸੀਂ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਕੋਈ ਮਤਲਬ ਡਰਾਈਵਰ ਹੈਗਾ ਆ ਜਿਹੜਾ ਕਿ ਪੂਰਾ ਇੱਕ ਦਿਨ ਵਾਸਤੇ ਮਤਲਬ ਡਰਾਈਵਿੰਗ ਕਰ ਸਕਦਾ ਆ ਤਾਂ ਤੁਸੀਂ ਸਾਨੂੰ ਦੱਸ ਦਿਓ ਅਤੇ ਉਹਦੇ ਹਿਸਾਬ ਦੇ ਨਾਲ ਫਿਰ ਅਸੀਂ ਆਪਣਾ ਜਿਹੜਾ ਪਲੈਨ ਆ ਉਹ ਪਲੈਨ ਮਤਲਬ ਕਰ ਸਕੀਏ ਕਿ ਆਪਾਂ ਕਿਹੜੀ ਕਿਹੜੀ ਜਗ੍ਹਾ ਘੁੰਮਣੀਆ ਵਾ ਅਤੇ ਜਿਹੜੇ ਵਿੱਚ ਕੀ ਆ ਜੇਕਰ ਤੁਹਾਡੇ ਜਿਹੜਾ ਡਰਾਈਵਰ ਆ ਟਾਈਮ 'ਤੇ ਨਹੀਂ ਆਉਂਦਾ ਹੈਗਾ ਅਤੇ ਅਸੀਂ ਜਿਹੜਾ ਵਾ ਉਹਦੇ ਹਿਸਾਬ ਦੇ ਨਾਲ ਹੁਣ ਕੋਈ ਡਿਸਟਰਬੈਂਸ ਨਾ ਹੋਵੇ ਅਤੇ ਜੇਕਰ ਮਤਲਬ ਕੋਈ ਲੇਟ ਹੋ ਜਾਂਦਾ ਹੈ ਤਾਂ ਤੁਹਾਡਾ ਡਰਾਈਵਰ ਜਿਹੜਾ ਆ ਅਤੇ ਸਾਡੇ ਕੋਲ ਜਿਹੜਾ ਸਾਡਾ ਪਲੈਨ ਜਿਹੜਾ ਕੈਂਸਲ ਹੁੰਦਾ ਆ ਅਤੇ ਇਹ ਤੁਹਾਡੇ ਉੱਤੇ ਮਤਲਬ ਅਸੀਂ ਕੀ ਐਕਸ਼ਨ ਲਵਾਂਗੇ ਅਤੇ ਜੇ ਤੁਸੀਂ ਸਾਨੂੰ ਇਹ ਦੱਸ ਦਿਓ ਕਿ ਜੇ ਤੁਸੀਂ ਕਰ ਸਕਦੇ ਹੋ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਕਿਤੋਂ ਹੋਰ ਜਿਹੜੀ ਕੈਬ ਆ ਉਹ ਬੁੱਕ ਕਰਾ ਲਈਏ ਅਤੇ ਜਿਹੜੇ ਅਸੀਂ ਏਰੀਆਸ ਘੁੰਮਣਾ ਚਾਹੁੰਦੇ ਹਾਂ ਉਹ ਅਸੀਂ ਅਲੈਂਟੇ ਮੋਲ ਜਾਣਾ ਆ ਅਤੇ ਉਸ ਤੋਂ ਬਾਅਦ ਅਸੀਂ ਸੁਖਨਾ ਝੀਲ ਦੇਖਣੀ ਆ ਉੱਥੋਂ ਵੀ ਸਾਡੇ ਨਾਲ ਕਾਫ਼ੀ ਸਾਰੇ ਜਿਹੜੇ ਸਾਡੇ ਮੈਂਬਰਸ ਨੇ ਫੈਮਲੀ ਮੈਂਬਰਸ ਹੈਗੇ ਨੇ ਉਹ ਸਾਡੇ ਨਾਲ ਜਾਣਗੇ ਥੋੜ੍ਹੇ ਟਾਈਮ ਅਸੀਂ ਉੱਥੇ ਰੁਕਾਂਗੇ ਫਿਰ ਲਾਗੇ ਦੇ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਨ ਜਾਵਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਵਾ ਇੱਕ ਪੂਰੇ ਦਿਨ ਦੇ ਲਈ ਸਾਨੂੰ ਮਤਲਬ ਜਿਹੜਾ ਕਿ ਕੈਬ ਜਿਹੜੀ ਬੁੱਕ ਕਰਾਉਣਾ ਚਾਹੁੰਦੇ ਹਾਂ ਅਤੇ ਦੇਖ ਲਓ ਅਗਰ ਤੁਹਾਡਾ ਜਿਹੜਾ ਡਰਾਈਵਰ ਆ ਟਾਈਮ ਸਿਰ ਜਿਹੜਾ ਆ ਸਕਦਾ ਆ ਤਾਂ ਤੁਸੀਂ ਸਾਨੂੰ ਦੱਸ ਦਿਓ ਅਤੇ ਨਹੀਂ ਤਾਂ ਫਿਰ ਅਸੀਂ ਆਪਣਾ ਕੁਛ ਪਲੈਨ ਕਰ ਸਕੀਏ